ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਨੇ ਵਧੀਆ ਹੋ ਸਿੰਘ ਕਮਿਊਨੀਕੇਸ਼ਨ ਤੋਂ ਬੋਲਦੇ ਹੋ ਤੇ ਮੈਂ ਸੈਮਸੰਗ ਦਾ ਮੋਬਾਈਲ ਔਡਰ ਕੀਤਾ ਸੀ ਅਤੇ ਇਹਦਾ ਰਿਜ਼ਲਟ ਕਾਫੀ ਵਧੀਆ ਆਇਆ ਇਸਦੀ ਜਿਹੜੀ ਪਿਕਚਰ ਕੁਆਲਿਟੀ ਆ ਬਹੁਤ ਵਧੀਆ ਹੈ ਸਾਊਂਡ ਬਹੁਤ ਵਧੀਆ ਹੈ ਅਤੇ ਇਸ ਦੀ ਬ੍ਰਾਈਟਨੈੱਸ ਬਹੁਤ ਵਧੀਆ ਹੈ ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਫੀਚਰਸ ਅਤੇ ਓਪਸ਼ਨ ਨੇ ਤੇ ਜਿਹੜੇ ਕਿ ਮੈਨੂੰ ਬਹੁਤ ਵਧੀਆ ਲੱਗੇ ਅਤੇ ਕੁਆਲਿਟੀ ਵਾਈਸ ਵੀ ਵਧੀਆ ਹੈ ਅਤੇ ਹਰ ਇੱਕ ਚੀਜ਼ ਇਸਦੀ ਸੁਪਰ ਡੁਪਰ ਹੈ ਅਤੇ ਇਸਦੇ ਕਾਫੀ ਫੰਕਸ਼ਨ ਹਨ ਜਿਹੜੇ ਕਿ ਅੱਜ ਲੇਟੈਸਟ ਵਰਜ਼ਨ ਦੇ ਵਿੱਚ ਕਈ ਫ਼ੋਨਾਂ ਦੇ ਵਿੱਚ ਜਿਵੇਂ ਕਿ ਆਈਫ਼ੋਨ ਦੇ ਵਿੱਚ ਵੀ ਨਹੀਂ ਆਉਂਦੇ ਜਿਵੇਂ ਕਿ ਇਸ ਦੇ ਵਿੱਚ ਕੋਲ ਰਿਕਾਰਡਿੰਗ ਮਿਲਦੀ ਹੈ ਠੀਕ ਹੈ ਦ ਸਕਰੀਨ ਸਕਰੀਨ ਲੋਕਿੰਗ ਬਹੁਤ ਜ਼ਿਆਦਾ ਫੀਚਰਸ ਨੇ ਜੋ ਕਿ ਇੱਕ ਆਈਫ਼ੋਨ ਦੇ ਵਿੱਚ ਵੀ ਨਹੀਂ ਹਨ ਅਤੇ ਇਸ ਤਰ੍ਹਾਂ ਦਾ ਜੇਕਰ ਕੋਈ ਹੋਰ ਫ਼ੋਨ ਆਇਆ ਤਾਂ ਮੈਨੂੰ ਮੁਹੱਈਆ ਕਰਵਾਇਓ ਜੀ